ਮੈਂ ਖੁਸ਼ਪਨੀਤ ਕੌਰ ਜਿਸਨੇ ਉਬਰ ਐਪ ਤੋਂ ਕੈਪ ਬੁੱਕ ਕੀਤੀ ਸੀ ਮੇਰੀ ਕਿਸੇ ਪਰਸਨਲ ਪ੍ਰੋਬਲਮ ਕਾਰਨ ਮੈਂ ਆਪਣਾ ਟਿਕਾਣਾ ਬਦਲ ਲਿਆ ਹੈ ਜੋ ਮੇਰੀ ਕੈਬ ਹੈ ਉਹ ਆਪਣੇ ਪੁਰਾਣੇ ਟਿਕਾਣੇ 'ਤੇ ਪਹੁੰਚ ਗਈ ਆ ਇਸ ਮੈਂ ਮੁਆਫੀ ਮੰਗਦੀ ਹਾਂ ਕਿ ਮੈਂ ਉਹਨਾਂ ਨੂੰ ਪਹਿਲਾਂ ਨਹੀਂ ਇਨਫੋਰਮ ਕੀਤਾ ਤਾਂ ਮੈਂ ਚਾਹੁੰਦੀ ਹਾਂ ਕਿ ਜੋ ਕੈਬ ਆ ਹੁਣ ਪਹਿਲਾਂ ਫਫੜੇ ਭਾਈ ਕੇ ਆਉਣ ਦੇ ਲਈ ਕਿਹਾ ਸੀ ਹੁਣ ਉਹ ਮਾਨਸਾ ਆ ਜਾਣ ਮਾਨਸਾ ਜੋ ਭਗਤ ਸਿੰਘ ਚੌਕ ਆ ਉਹਨਾਂ ਨੂੰ ਮੈਂ ਉੱਥੇ ਹੀ ਮਿਲਾਂਗੀ ਮੈਂ ਮੁਆਫੀ ਮੰਗਦੀ ਹਾਂ ਕਿ ਮੈਂ ਪਹਿਲਾਂ ਨਹੀਂ ਇਨਫੋਰਮ ਕਰ ਸਕੀ ਹੈਗੀ ਹੈਗੀ ਕਿਰਪਾ ਕਰਕੇ ਜੋ ਕੈਬ ਹੈ ਹੁਣ ਉਹ ਮਾਨਸਾ ਪਹੁੰਚਾਈ ਜਾਵੇ ਮੈਂ ਚਾਹੁੰਦੀ ਹਾਂ ਕਿ ਪਲੀਜ਼ ਥੋੜ੍ਹਾ ਜਿਹਾ ਜਲਦੀ ਆਉਣ ਉਹ ਕਿਉਂਕਿ ਮੈਂ ਸੰਗਰੂਰ ਪਹੁੰਚਣਾ ਹੈ ਕਿਸੇ ਫੈਮਿਲੀ ਫੰਕਸ਼ਨ ਦੇ ਲਈ ਤਾਂ ਜੋ ਮੈਂ ਆਪਣਾ ਟਾਈਮ 'ਤੇ ਪਹੁੰਚ ਸਕਾਂ ਕਿਰਪਾ ਕਰਕੇ ਉਹਨਾਂ ਨੂੰ ਹੁਣ ਮਾਨਸਾ ਪਹੁੰਚਣ ਦੇ ਲਈ ਇਨਫੋਰਮ ਕੀਤਾ ਜਾਵੇ